ਹਾਂਜੀ ਮੈਂ ਮਨਪ੍ਰੀਤ ਬੋਲ ਰਹੀ ਹਾਂ ਹ ਹਾਂਜੀ ਮੈਂ ਦਿੱਲੀ ਤੋਂ ਨਾ ਮੋਹਾਲੀ ਆਉਣਾ ਸੀਗਾ ਮੈਨੂੰ ਥੋੜ੍ਹਾ ਤੁਸੀਂ ਦੱਸ ਸਕਦੇ ਹੋ ਕਿ ਕਿੱਦਾਂ ਦਾ ਮੌਸਮ ਹੈ ਇੱਧਰ ਕਿੱਦਾਂ ਦੇ ਕੱਪੜੇ ਵਗੈਰਾ ਲੈ ਕੇ ਆਵਾਂ ਮੈਂ ਦੋ ਤਿੰਨ ਮਹੀਨੇ ਵਾਸਤੇ ਇੱਥੇ ਟ੍ਰੇਨਿੰਗ ਵਾਸਤੇ ਆਉਣਾ ਤੁਸੀਂ ਮੈਨੂੰ ਥੋੜ੍ਹਾ ਦੱਸੋ ਇੱਧਰ ਕਿੱਦਾਂ ਦਾ ਮੌਸਮ ਵਗੈਰਾ ਹੈਗਾ ਹਾਂਜੀ ਹਾਂਜੀ ਠੀਕ ਠੀਕ ਹੈ ਹਾਂਜੀ ਹਾਂਜੀ ਅਤੇ ਥੋੜ੍ਹਾ ਮਾਰਕੀਟ ਵਗੈਰਾ ਦਾ ਮੈਨੂੰ ਦੱਸ ਦਿਓ ਕਿ ਇੱਦਾਂ ਕਿਦਾਂ ਦੀ ਮਾਰਕੀਟ ਹੈ ਮੈਂ ਥੋੜ੍ਹਾ ਐਡਰੈੱਸ ਵਗੈਰਾ ਮੈਨੂੰ ਸੈਂਡ ਕਰ ਦਿਓ ਮੈਂ ਕੁਝ ਖਰੀਦਣਾ ਪੈ ਜਾਂਦਾ ਏ ਕੋਈ ਅਮਰਜੈਂਸੀ ਪੈ ਜਾਂਦੀ ਹੈ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਂਦੀ ਹੈ ਉਹਦੇ ਕਰਕੇ ਹਾਂਜੀ ਮੋਹਾਲੀ 'ਚ ਨਹੀਂ ਹੈ ਕੋਈ ਨੇੜੇ ਜੀ ਅਤੇ ਮੈਂ ਰਹਿਣਾ ਕੋਈ ਪੀ ਜੀ ਵਗੈਰਾ ਕੁਝ ਵੀ ਹੈ ਤੁਹਾਡੇ ਘਰ ਰਹਿਣਾ ਕਿਤੇ ਵੀ ਰਹਿਣਾ ਹੋਇਆ ਉਹਦੇ ਉਹਦੇ ਨੇੜੇ ਕੋਈ ਮਾਰਕੀਟ ਹੋਵੇ ਮੈਨੂੰ ਕੋਈ ਜ਼ਰੂਰਤ ਐਟ ਏ ਟਾਈਮ ਜ਼ਰੂਰਤ ਪੈ ਸਕਦੀ ਹੈ ਚੀਜ਼ ਦੀ ਤਾਂ ਮੈਂ ਖਰੀਦ ਸਕਾਂ

ਠੀਕ ਹੈ ਠੀਕ ਹੈ ਠੀਕ ਹੈ ਵੈਸੇ ਮੌਸਮ ਠੀਕ ਹੈ ਜ਼ਿਆਦਾ ਕੱਪੜੇ ਚੱਕਣ ਦੀ ਜ਼ਰੂਰਤ ਨਹੀਂ ਗਰਮੀਆਂ ਦੀ ਜਿੱਦਾਂ ਹੁਣ ਗਰਮੀ ਨਿਕਲ ਚੁੱਕੀ ਹੈ ਨਾ ਇੱਧਰ ਠੀਕ ਹੈ ਤੁਹਾਡਾ ਮੌਸਮ ਨਾ ਠੀਕ ਠੀਕ ਠੀਕ ਹੈ ਚਲੋ ਠੀਕ ਹੈ ਕੋਈ ਨਹੀਂ ਫਿਰ ਜੇ ਮੈਨੂੰ ਜ਼ਰੂਰਤ ਪਈ ਤਾਂ ਫਿਰ ਮੈਂ ਤੁਹਾਨੂੰ ਕੋਲ ਕਰ ਲਵਾਂਗੀ ਹਾਂਜੀ ਹਾਂਜੀ